ਭਾਰਤ ਦੀ ਸਭ ਤੋਂ ਵੱਡੀ ਮਹੱਤਵਪੂਰਨ ਚੁਣੌਤੀ ਗਰੀਬੀ ਬੇਰੁਜ਼ਗਾਰੀ ਅਤੇ ਲੋਕਾਂ ਦੇ ਜੀਵਨ ਜਾਪਣ ਲਈ ਮੁੱਢਲੀ ਸੁਵਿਧਾਵਾਂ ਦੀ ਘਾਟ ਹੈ ਅੱਜ ਭਾਰਤ ਵਿੱਚ ਹਰ ਸਾਲ ਲੱਖਾਂ ਨੌਜਵਾਨ ਆਪਣੀ ਪੜ੍ਹਾਈ ਪੜ੍ਹ ਕੇ ਵੀ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਕੰਮ ਨਾ ਮਿਲਣ ਕਰਕੇ ਇਸ ਦੇ ਨਾਲ ਦੇਸ਼ ਵਿੱਚ ਸਾਡੀ ਨੌਜਵਾਨ ਪੀੜ੍ਹੀ ਗਲਤ ਕੰਮਾਂ ਵਿੱਚ ਪੈ ਰਹੀ ਹੈ ਨੌਜਵਾਨ ਨਸ਼ੇ ਪੱਤੇ ਦੇ ਚੱਕਰਾਂ ਵਿੱਚ ਫਸ ਜਾਂਦੇ ਹੈ ਕਈ ਨੌਜਵਾਨ ਚੋਰ ਬਣ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਹੈ ਇਸ ਤਰ੍ਹਾਂ ਸਾਡਾ ਨੌਜਵਾਨ ਸਮਾਜ ਜਿਹੜਾ ਕਿ ਭਾਰਤ ਦਾ ਆਉਣ ਵਾਲਾ ਭਵਿੱਖ ਹੈ ਜੇ ਉਹ ਬਰਬਾਦ ਹੋ ਜਾਵੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਕੀ ਬਣੇਗਾ ਸਰਕਾਰ ਨੂੰ ਇਸ ਲਈ ਬੜੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਛੋਟੇ ਛੋਟੇ ਪੱਧਰ ਦੇ ਅਲੱਗ ਅਲੱਗ ਹਲਕਿਆਂ ਵਿੱਚ ਸਕੂਲ ਖੋਲ੍ਹ ਕੇ ਕੋਈ ਸਕਿਲ ਦੀ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਜਿਸ ਦੇ ਨਾਲ ਬੱਚਾ ਆਪਣਾ ਕੰਮ ਕਰ ਸਕੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਨੂੰ ਪਹਿ ਉਸ ਦੀ ਪੈਸੇ ਦੀ ਕਮੀ ਨੂੰ ਦੂਰ ਕਰਨ ਲਈ ਬਿਨਾਂ ਵਿਆਜ 'ਤੇ ਕਰਜ਼ਾ ਮੁਹੱਈਆ ਕਰਾਇਆ ਜਾਏ ਅਤੇ ਨੋਜਵਾਨ ਪੀੜ੍ਹੀ ਦੇ ਭਵਿੱਖ ਦੇ ਬਾਰੇ ਵਿੱਚ ਕੁਛ ਸੋਚਿਆ ਜਾਵੇ ਅਤੇ ਸਾਡੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ ਅਤੇ ਦੇਸ਼ ਦੀ ਇਸ ਦੇਸ਼ ਦੀ ਨਵੀਂ ਪੀੜ੍ਹੀ ਨੂੰ ਅੱਗੇ ਲਿਆਇਆ ਜਾਵੇ